ਵੈਸੇ ਤਾਂ ਪੰਜਾ ਪੰਜਾਬ ਲਾ ਲਉ ਜਾਂ ਭਾਰਤ ਲਾ ਲਉ ਵੱਖ ਵੱਖ ਤਰੀਕੇ ਦੀ ਚੀਜ਼ਾਂ ਬਣਾਈ ਜਾਂਦੀ ਹਨ ਬਟ ਜਿਹੜਾ ਮੇਰਾ ਇਲਾਕਾ ਹੈ ਜਿਹਦੇ ਵਿੱਚ ਮੈਂ ਰਹਿੰਦੀ ਹਾਂ ਓਸ ਇਲਾਕੇ ਵਿੱਚ ਬੱਚਿਆਂ ਦੇ ਕੱਪੜੇ ਉੱਨ ਨਾਲ ਬਣਾਏ ਜਾਂਦੇ ਹਨ ਜਿਹਨੂੰ ਸਿਲਾਈਆਂ ਦਾ ਇਸਤੇਮਾਨ ਕਰਕੇ ਇੱਕ ਡਿਜ਼ਾਇਨ ਦਿੱਤਾ ਜਾਂਦਾ ਹੈ ਅਤੇ ਤਿਆਰ ਕੀਤਾ ਜਾਂਦਾ ਹੈ ਇਹ ਸਪੈਸ਼ਲ ਕੱਪੜੇ ਇਸ ਕਰਕੇ ਵੀ ਹੁੰਦੇ ਹਨ ਕਿ ਜਾਂ ਤਾਂ ਇਹ ਕਿਸੇ ਦੀ ਦਾਦੀ ਜਾਂ ਕਿਸੇ ਦੀ ਨਾਨੀ ਨੇ ਬਣਾਏ ਹੁੰਦੇ ਹਨ ਇਸ ਕਰਕੇ ਇਸ ਕਰਕੇ ਇਹਨਾਂ ਕੱਪੜਿਆਂ 'ਚ ਉਹਨਾਂ ਦਾ ਪਿਆਰ ਵੀ ਛਿਪਿਆ ਹੁੰਦਾ ਹੈ ਅਤੇ ਇਹ ਕੱਪੜੇ ਹੀ ਪੰਜਾਬ ਜਾਂ ਹ ਪੰਜਾਬ ਲਾ ਲਓ ਜਾਂ ਭਾਰਤ ਲਾ ਲਓ ਹਰੇਕ ਕੋਨੇ ਵਿੱਚ ਕਿਸੇ ਨਾ ਕਿਸੇ ਦੇ ਘਰ ਤਾਂ ਹਮੇਸ਼ਾਂ ਹੀ ਬਣਦੇ ਹਨ ਜਿਨ੍ਹਾਂ ਦੇ ਘਰ ਵੱਡੇ ਬਜ਼ੁਰਗ ਹੁੰਦੇ ਹਨ ਤਾਂ ਇਸ ਤਰ੍ਹਾਂ ਦੇ ਹੀ ਕੱਪੜੇ ਸਾਡੇ ਖੇਤਰ ਵਿੱਚ ਬਣਾਏ ਜਾਂਦੇ ਹਨ